ਹੈਲੋ ਮੈਂ ਸਰਹਿੰਦ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੀ ਹਾਂ ਅੱਜ ਕੱਲ੍ਹ ਜਿੰਨਾ ਰਸ਼ ਰਹਿੰਦਾ ਹੈ ਅਤੇ ਗੱਡੀਆਂ ਬਹੁਤ ਮਹਿੰਗੀਆਂ ਨੇ ਉਬਰ ਇੱਕ ਸੌਖਾ ਤਰੀਕਾ ਹੈ ਆਉਣ ਜਾਣ ਲਈ ਉਬਰ ਦਾ ਇੱਕ ਫਾਇਦਾ ਵੀ ਬਿਨਾ ਸਮਾਂ ਖ਼ਰਾਬ ਕੀਤੇ ਟੈਕਸੀ ਘਰ ਤੋਂ ਹੀ ਪਿੱਕ ਕਰ ਲੈਂਦੀ ਹੈ ਇੱਕ ਸਟਾਰ ਦਾ ਮਤਲਬ ਹੈ ਵੀ ਗੱਡੀ ਖ਼ਰਾਬ ਹੈ ਸਫ਼ਰ 'ਚ ਦਿੱਕਤ ਦੇਵੇਗੀ ਤਿੰਨ ਚਾਰ ਸਟਾਰ ਦਾ ਮਤਲਬ ਹੈ ਸਫ਼ਰ ਆਰਾਮਦਾਇਕ ਹੈ ਗੱਡੀ ਸਹੀ ਰਹਿੰਦੀ ਹੈ ਅਤੇ ਬੰਦਾ ਭਰੋਸੇਮੰਦ ਹੈ ਤਾਂ ਮੈਂ ਪੁੱਛਣਾ ਚਾਹੁੰਦੀ ਸੀ ਕਿ ਤਿੰਨ ਚਾਰ ਰੇਟਿੰਗ ਵਾਲੇ ਕਿਸੇ ਡਰਾਈਵਰ ਬਾਰੇ ਤੁਸੀਂ ਜੇ ਦੱਸ ਸਕੋ ਜਾਂ ਫਿਰ ਮੈਨੂੰ ਹਰ ਇੱਕ ਤਰ੍ਹਾਂ ਦੀ ਰੇਟਿੰਗ ਵਾਲੇ ਡਰਾਈਵਰ ਬਾਰੇ ਦੱਸੋ ਅਤੇ ਉਹਨਾਂ ਦੀ ਫੀਡਬੈਕ ਬਾਰੇ ਵੀ ਦੱਸੋ